ਜਦੋਂ ਮੈਂ ਆਪਣੇ ਬਾਗ ਵਿੱਚ ਨਵੇਂ ਨਵੇਂ ਫੁੱਲ ਉੱਗੇ ਵੇ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲੱਗਦਾ ਸਵੇਰੇ ਮੈਨੂੰ ਬਾਗਬਾਨੀ ਬਹੁਤ ਕਰਨੀ ਪਸੰਦ ਹੈ ਔਰ ਸਵੇਰੇ ਉੱਠ ਕੇ ਉਹਨਾਂ 'ਚ ਪਾਣੀ ਪਾਉਣਾ ਬਹੁਤ ਪਸੰਦ ਆ ਮੈਨੂੰ ਮੈਨੂੰ ਜ਼ਿਆਦਾਤਰ ਗੁਲ ਗੁਲਾਬ ਦੇ ਪੌਦੇ ਜਾਂ ਗੈਂਦੇ ਦੇ ਪੌਦੇ ਜਾਂ ਫੁੱਲਾਂ ਦੇ ਪੌਦੇ ਮੈਨੂੰ ਬਹੁਤ ਪਸੰਦ ਆ ਇਸ ਤੋਂ ਇਲਾਵਾ ਮੈਨੂੰ ਮੈਂ ਹੋਰ ਵੀ ਆਪਣੇ ਘਰ 'ਚ ਜਿਵੇਂ ਸਬਜ਼ੀਆਂ ਵਗੈਰਾ ਲਗਾਈਆਂ ਹੋਈਆਂ ਉਹਨਾਂ ਦਾ ਵੀ ਬਹੁਤ ਠੀਕ ਏ ਲੱਗਦਾ ਜਿਵੇਂ ਆਪਾਂ ਨੂੰ ਬਿਨਾਂ ਸਪਰੇਅ ਤੋਂ ਘਰ ਵਿੱਚ ਖਾਣ ਵਾਸਤੇ ਸਬਜ਼ੀਆਂ ਮਿਲ ਜਾਂਦੀਆਂ ਜਿਵੇਂ ਮੀ ਨਿੰਬੂ ਹੁਣ ਬਹੁਤ ਮਹਿੰਗੇ ਹੋਏ ਵੇ ਹੈ ਨਿੰਬੂ ਮੈਂ ਆਪਣੇ ਘਰ ਲਗਾਇਆ ਹੋਇਆ ਔਰ ਨਿੰਬੂ ਵੀ ਬਹੁਤ ਵਧੀਆ ਲੱਗੇ ਹੋਏ ਐਂ ਔਰ ਮੈਨੂੰ ਬਹੁਤ ਵਧੀਆ ਲੱਗਦਾ ਮ ਪੌਦਿਆਂ 'ਚ ਰਹਿਣਾ ਸਵੇਰੇ ਸਵੇਰੇ ਉਹਨਾਂ ਨੂੰ ਪਾਣੀ ਦੇਣਾ ਖਾਦ ਦੇਣਾ ਚੰਗਾ ਲੱਗ ਜਿਵੇਂ ਵੇਲਾਂ ਲਗਾਈਆਂ ਹੋਈਆਂ ਕਰੇਲੇ ਦੀ ਔਰ ਘੀਆ ਦੀ ਇਹ ਵੀ ਬਹੁਤ ਵਧੀਆ ਉੱਗੇ ਹੋਏ ਆ ਮੈਂ ਤਾਂ ਕਹਿੰਦੀ ਸਾਰਿਆਂ ਨੂੰ ਇਹ ਥੋੜ੍ਹੇ ਬਹੁਤੇ ਜਿੰਨੀ ਕੁ ਵੀ ਜਗ੍ਹਾ ਹੋਵੇ ਚਾਹੇ ਗਮਲੇ ਵਿੱਚ ਹੋਵੇ ਚਾਹੇ ਛੱਤ 'ਤੇ ਹੋਵੇ ਥੋੜ੍ਹੇ ਬਹੁਤੀ ਬਾਗਬਾਨੀ ਕਰ ਲੈਣੀ ਚਾਹੀਦੀ ਹੈ ਸਾਰਿਆਂ ਨੂੰ